ਹੈਲੋ ਹਾਂਜੀ ਭਾਅ ਜੀ ਹਰਮਨ ਡਰੈਕਟਰ ਬੋਲ ਰਹੇ ਓਂ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਮੈਂ ਨਾ ਗੁਰਕਵਲ ਸਿੰਘ ਬੋਲ ਰਿਹਾਂ ਤੇ ਮੈਂ ਭਾਅ ਜੀ ਨਾ ਮਾੜਾ ਮੋਟਾ ਐਕਟਿੰਗ ਉਕਟਿੰਗ ਕਰ ਲੈਂਦਾ ਹੁੰਨਾ ਇੱਕ ਸਿੰਪਲ ਐਕਟਰ ਆਂ ਸਾਈਡ ਦਾ ਸਾਈਡ ਐਕਟਰ ਤੇ ਭਾਅ ਜੀ ਮੇਰੇ ਲਾਈਕ ਕੋਈ ਰੋਲ ਰੂਲ ਮਿਲ ਸਕਦਾ ਥੋਡੇ ਕੋਲ ਮੈਨੂੰ ਭਾਅ ਜੀ ਹੋ ਗੇ ਜੀ ਟੋਟਲ ਚਾਰ ਕ ਸਾਲ ਹੋਗੇ ਨੇ ਕੰਮ ਕਰਦੇ ਹੋਏ ਏਹੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਭਾਅ ਜੀ ਪੈਸ਼ਨ ਏ ਐ ਜੀ ਹਾਂਜੀ ਹਾਂਜੀ ਤੇ ਭਾਅ ਜੀ ਜਿਹੜਾ ਵੀ ਥੋਨੂੰ ਵਧੀਆ ਲੱਗੇ ਇੱਕ ਵਾਰੀ ਮੈਂ ਥੋਨੂੰ ਆਪਣੀ ਫੋਟੋ ਵੀ ਥੋਨੂੰ ਮੈਂ ਮਿਲ ਵੀ ਲਾਊਂਗਾ ਤੇ ਮਿਲ ਕੇ ਥੋਨੂੰ ਜੈਹੇ ਜਿਹਾ ਮਤਲਬ ਲੱਗੇ ਰੋਲ ਜਿਹੜਾ ਮੇਰੇ ਲਾਈਕ ਹੋਵੇ ਸੋ ਉਹ ਤੁਸੀਂ ਮੈਨੂੰ ਫੇਰ ਦੇ ਦਿਓ ਮੈਂ ਭਾਅ ਜੀ ਸਿ ਓ ਸਿੰਗਰਾਂ ਨਾਲ ਵੀ ਕੰਮ ਕੀਤਾ ਹੋਇਆ ਜੀ ਉਨ੍ਹਾਂ ਦੀ ਵੀਡੀਓ ਵੂਡੀਓ ਚ ਮੈਂ ਆਇਆਂ ਹੋਇਆਂ ਇੱਕ ਸਾਈਡ ਐਕਟਰ ਤੇ ਇੱਕ ਮੈਂ ਫਿਲਮ 'ਚ ਵੀ ਆਇਆਂ ਹੋਇਆਂ ਹਾਂਜੀ ਹਾਂਜੀ ਭਾਅ ਜੀ ਸਾਈਡ ਐਕਟਿੰਗ ਦਾ ਕੀਤਾ ਸੀ ਤੇ ਇੱਕ ਵਾਰੀ ਸਿੰਗਰ 'ਚ ਮੈਂ ਮੇਨ ਰੋਲ ਵੀ ਕੀਤਾ ਸੀਗਾ ਗਾਣਾ ਕਿਸੇ ਹੋਰ ਸਿੰਗਰ ਨੇ ਸਿੰਗ ਕੀਤਾ ਸੀਗਾ ਹਾਂਜੀ ਹਾਂਜੀ ਭਾਅ ਜੀ ਓ ਇੱਕ ਵਾਰੀ ਭਾਅ ਜੀ ਉਹ ਤਾਂ ਫੇਰ ਚਲੋ ਮਿਲ ਕੇ ਗੱਲ ਕਰਲਾਂਗੇ ਜਿਵੇਂ ਥੋਨੂੰ ਮੈਂ ਲੱਗਿਆ ਦੇਖ ਕੇ ਕੇ ਮੇਨ ਐਕਟਰ ਵਾਸਤੇ ਵਧੀਆ ਲੱਗਿਆ ਤਾਂ ਮੈਨੂੰ ਮੇਨ ਦਾ ਦੇ ਦਿਓ ਰੋਲ ਤੇ ਜੇ ਥੋਨੂੰ ਮੈਂ ਸਾਈਡ ਐਕਟਰ ਦਾ ਲੱਗਿਆ ਤਾਂ ਸਾਈਡ ਆਲੇ ਐਕਟਰ ਦਾ ਦੇ ਦਿਓ ਫੇਰ ਹਾਂਜੀ ਹਾਂਜੀ ਭਾਅ ਜੀ ਮੈਂ ਘਰੇ ਵੀ ਰੋਜ ਪ੍ਰੈਕਟਿਸ ਕਰਦਾ ਰਹਿਨਾ ਹਾਂਜੀ ਅੱਛਾ ਜੀ ਠੀਕ ਐ ਭਾਅ ਜੀ ਠੀਕ ਐ ਜੀ ਮੈਂ ਜਰੂਰ ਮਿਲੂੰਗਾ ਜੀ ਐਕਟਿੰਗ ਦੇ ਵਿੱਚ ਭਾਵੇਂ ਜੀ ਭਾਜੀ ਤੁਸੀਂ ਲਾ ਲੋ ਜਿਵੇਂ ਇੱਕ ਸਾਈਡ ਐਕਟਰ ਹੋ ਗਿਆ ਇੱਕ ਮੇਨ ਰੋਲ ਹੋ ਗਿਆ ਜਿਹੜਾ ਵੀ ਹੋਊਂਗਾ ਨਾ ਮੇਨ ਕਿਰਦਾਰ ਹੋ ਗਿਆ ਜਿਹੜਾ ਵੀ ਗਾਣੇ ਦਾ ਹੋ ਗਿਆ ਚਾਹੇ ਫਿਲਮ ਦਾ ਹੋ ਗਿਆ ਉਹ ਵੀ ਕਰ ਲੈਨਾ ਤੇ ਐਜ ਅ ਟਾਈਪ ਓਫ ਜਿਵੇਂ ਆਪਾਂ ਕਹਿ ਲੈਂਦੇ ਹੁੰਨੇ ਆਂ ਫ਼ਿਲਮਾਂ 'ਚ ਇੱਕ ਦੁਸ਼ਮਣ ਨੀ ਹੁੰਦਾ ਆਪਾਂ ਦੁਸ਼ਮਣ ਟਾਈਪ ਹਨਾ ਤੇ ਮੈਂ ਉਹ ਵੀ ਰੋਲ ਕਰ ਲੈਨਾ ਹਾਂਜੀ ਵਿਲਨ ਦਾ ਰੋਲ ਮੇਰੀ ਭਾਅ ਜੀ ਏਜ ਹੈਗੀ ਐ ਜੀ ਬਾਈ ਸਾਲ ਹਾਂਜੀ ਹਾਂਜੀ ਹਾਂਜੀ ਭਾਅ ਜੀ ਉਹ ਥੋੜਾ ਜਿਆ ਚਲੋ ਗੁੱਡ ਲੁਕਿੰਗ ਕਰਕੇ ਨਾ ਥੋੜਾ ਜਿਆ ਫੇਰ ਚਲੋ ਇੱਕ ਥੋੜਾ ਜਿਆ ਪਰਸਨੈਲਿਟੀ ਵਧੀਆ ਸੀ ਜੀ ਸੋ ਇਸ ਕਰਕੇ ਮਾੜਾ ਮੋਟਾ ਕੰਮ ਵਧੀਆ ਚੱਲੀ ਗਿਆ ਹਾਂਜੀ ਹਾਂਜੀ ਭਾਅ ਜੀ ਜਰੂਰ ਮੈਂ ਥੋਨੂੰ ਏਹੀ ਹਾਂਜੀ ਭਾਅ ਜੀ ਏਹੀ ਨੰਬਰ ਭਾਅ ਜੀ ਥੋਡਾ ਚਲਦਾ ਐ ਵਟਸਐਪ ਤੇ ਬਸ ਥੋਨੂੰ ਭਾਅ ਜੀ ਮੈਂ ਵਟਸਐਪ ਤੇ ਨਾ ਇੱਕ ਵਾਰੀ ਬਾਇਓਡਾਟਾ ਭੇਜ ਦਿੰਦਾ ਸਾਰਾ ਲਿਖ ਕੇ ਤੇ ਤੁਸੀਂ ਅੱਗੇ ਫੇਰ ਮੈਨੂੰ ਉਸ ਸਾਬ ਨਾਲ ਬਾਕੀ ਰੋਲ ਦੱਸ ਦਿਓ ਜਿਵੇਂ ਹੋਇਆ ਹਾਂ ਓਕੇ ਓਕੇ ਭਾਅ ਜੀ ਓਕੇ ਓਕੇ